ਜਿਹੜੇ ਮਤਲਬ ਕਿ ਸਥਾਨਕ ਬੈਂਕ ਜਾਂ ਧਾਰਮਿਕ ਸਮੂਹ ਨੇ ਹਾਂ ਕਈ ਲੋਕ ਮਤਲਬ ਇਹਨਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਨੇ ਪਰ ਮੈਂ ਕਦੀ ਮਤਲਬ ਇੱਦਾਂ ਦੀ ਸਹਾਇਤਾ ਪ੍ਰਾਪਤ ਨਹੀਂ ਕਰਤੀ ਜਿਵੇਂ ਕਿ ਅ ਬੈਂਕ ਨੇ ਗੇ ਮਤਲਬ ਕਿ ਕਿਸੇ ਨੂੰ ਵੀ ਅਗਰ ਇਮੀਜੇਟਲੀ ਕੋਈ ਜ਼ਰੂਰਤ ਹੁੰਦੀ ਹੈ ਪੈਸੇ ਦੀ ਤਾਂ ਉਹ ਬੈਂਕ ਦੀ ਸਹਾਇਤਾ ਨਾਲ ਜਿਵੇਂ ਲੋਨ ਵਗੈਰਾ ਕਰਵਾ ਕੇ ਆਪਣੀ ਮਤਲਬ ਨੀਡ ਨੂੰ ਹੈ ਜਿਹੜਾ ਪੂਰਾ ਕਰ ਲੈਂਦੇ ਨੇ ਉਦਾਂ ਹੀ ਜਿਵੇਂ ਧਾਰਮਿਕ ਸਮੂਹ ਨੇ ਬਹੁਤ ਸਾਰੇ ਜਿਹੜੇ ਕਿ ਹੈ ਮਤਲਬ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਅਤੇ ਉਹਨਾਂ ਨੂੰ ਮਤਲਬ ਇੱਕ ਵਧੀਆ ਢੰਗ ਨਾਲ ਜਿਹੜਾ ਉਹਨਾਂ ਦਾ ਇੱਕ ਜ਼ਰੂਰਤ ਨੂੰ ਕੀ ਹੈ ਪੂਰਾ ਕਰ ਦਿੰਦੇ ਨੇ ਜਿਵੇਂ ਕਈ ਮਤਲਬ ਬੱਚੀਆਂ ਦੇ ਵਿਆਹ ਵਗੈਰਾ ਵੀ ਔਰਗਨਾਈਜ਼ ਕਰਦੇ ਨੇ ਜਿਹਦੇ ਨਾਲ ਕੀ ਹੈ ਇੱਕ ਗਰੀਬ ਫੈਮਿਲੀ ਨੂੰ ਉਸ ਦਾ ਮਤਲਬ ਫਾਇਦਾ ਮਿਲ ਜਾਂਦਾ